ਪੰਦਰ੍ਹਾਂ ਨਵੰਬਰ ਉੱਨੀ ਸੌ ਵੀਹ ਬਾਰ੍ਹਾਂ ਜਨਵਰੀ ਦੋ ਹਜ਼ਾਰ ਸਤਾਰ੍ਹਾਂ ਦੋ ਦਸੰਬਰ ਦੋ ਹਜ਼ਾਰ ਦੋ ਛੱਬੀ ਅਗਸਤ ਉੱਨੀ ਸੌ ਸੈਂਤੀ ਅਠਾਰ੍ਹਾਂ ਅਗਸਤ ਦੋ ਹਜ਼ਾਰ ਤਿੰਨ